ਹਾਂਜੀ ਮੈਂ ਸਿਮਰਨਜੀਤ ਕੌਰ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਪਾਣੀ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਪਾਣੀ ਬਹੁਤ ਅਸ਼ੁੱਧ ਹੋ ਚੁੱਕਾ ਆ ਸੋ ਇਹਨੂੰ ਸ਼ੁੱਧ ਕਰਨ ਵਾਸਤੇ ਅਸੀਂ ਘਰੇਲੂ ਉਪਾਅ ਯੂਜ ਕਰਦੇ ਹਾਂ ਕਿ ਪਾਣੀ ਨੂੰ ਉਬਾਲ ਕੇ ਠੰਡਾ ਕਰ ਲਿਆ ਜਾਵੇ ਅਤੇ ਪਾਣੀ ਨੂੰ ਛਾਣ ਲਿੱਤਾ ਜਾਵੇ ਤਾਂ ਜੋ ਪਾਣੀ ਦੀ ਸਾਰੀ ਗੰਦਗੀ ਆ ਕੀਟਾਣੂ ਆ ਸਾਰੇ ਮਰ ਜਾਂਦੇ ਨੇ ਜਿਹਦਾ ਕਰਕੇ ਪਾਣੀ ਥੋੜ੍ਹਾ ਸ਼ੁੱਧ ਹੋ ਜਾਂਦਾ ਆ ਕਿਉਂਕਿ ਪਾਣੌ ਪਾਣੀ ਇੱਕ ਬਹੁਤ ਹੀ ਜ਼ਰੂਰਤ ਵਾਲੀ ਚੀਜ਼ ਹੈ ਜਿਹਦੇ ਬਗੈਰ ਨਹੀਂ ਸਰਦਾ ਜਿਹਦੇ ਕਰਕੇ ਲੱਖਾਂ ਹੀ ਬਿਮਾਰੀਆਂ ਹੁੰਦੀਆਂ ਨੇ ਸੋ ਅੱਜ ਕੱਲ੍ਹ ਬਹੁਤ ਹੀ ਅਸ਼ੁੱਧਤਾ ਆ ਰਹੀ ਹੈ ਪਾਣੀ ਦੇ ਵਿੱਚ ਸੋ ਅੱਜ ਕੱਲ੍ਹ ਸਮਰਸੀਬਲ ਬੋਰ ਵੀ ਹੋ ਰਹੇ ਨੇ ਅਤੇ ਉਹਦੇ ਕਰਕੇ ਪਾਣੀ ਥੋੜ੍ਹਾ ਡੂੰਘਿਆਈ ਤੋਂ ਪ੍ਰਾਪਤ ਹੁੰਦਾ ਸੋ ਇਹ ਪਾਣੀ ਸਾਫ਼ ਆਉਂਦਾ ਆ ਇਸ ਕਰਕੇ ਪਾਣੀ ਨੂੰ ਸ਼ੁੱਧ ਕੀਤਾ ਹੀ ਸ਼ੁੱਧ ਕਰਕੇ ਹੀ ਪੀਤਾ ਜਾਵੇ ਅਸੀਂ ਤਾਂ ਆਪਣੇ ਘਰ ਦੇ ਵਿੱਚ ਚਲੋ ਫਿਲਟਰ ਵੀ ਲਗਵਾਇਆ ਆ ਅਤੇ ਇਸ ਮਰਸੀਬਲ ਬੋਰ ਵੀ ਕਰਵਾਇਆ ਆ ਅਤੇ ਜਿਦੇ ਕਿਤੇ ਜ਼ਰੂਰਤ ਪਏ ਤਾਂ ਫਿਰ ਪਾਣੀ ਨੂੰ ਉਬਾਲ ਲੈਂਦੇ ਹਾਂ ਫਿਰ ਉਹਨੂੰ ਛਾਣ ਲੈਂਦੇ ਹਾਂ ਫਿਰ ਠੰਡਾ ਕਰਕੇ ਬੋਤਲਾਂ 'ਚ ਪਾ ਕੇ ਫਿਰ ਜ਼ਰੂਰਤ ਅਨੁਸਾਰ ਵਰਤ ਲਈਦਾ ਆ ਸੋ ਪਾਣੀ ਦੀ ਸ਼ੁੱਧਤਾ ਬਹੁਤ ਜ਼ਰੂਰੀ ਹੈ ਸੋ ਕਿਰਪਾ ਸਾਰਿਆਂ ਨੂੰ ਹੀ ਮਿਹਰਬਾਨੀ ਕਰਕੇ ਇਹ ਬੇਨਤੀ ਹੈ ਕਿ ਪਾਣੀ ਦੀ ਸ਼ੁੱਧਤਾ ਕਰਕੇ ਫਿਰ ਹੀ ਉਹਨੂੰ ਵਰਤੋ